ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਹਾਂਜੀ ਅਸੀਂ ਪੰਜਾਬ ਦੇ ਪੁਰਾਣੇ ਰਹਿਣ ਵਾਲੇ ਹਾਂ ਜੀ ਤੁਹਾਨੂੰ ਜਿਵੇਂ ਕਿ ਪਟਿਆਲਾ ਜ਼ਿਲ੍ਹਾ ਹੋ ਗਿਆ ਲੁਧਿਆਣਾ ਸ਼ਹਿਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਇੱਥੇ ਜੁੱਤੀਆਂ ਬਹੁਤ ਜ਼ਿਆਦਾ ਵਧੀਆ ਮਿਲਦੀਆਂ ਨੇ ਜਿੱਥੋਂ ਤੁਸੀਂ ਆਪਣੀਆਂ ਜੁੱਤੀਆਂ ਅਤੇ ਫੁਲਕਾਰੀਆਂ ਲੈ ਸਕਦੇ ਹੋ ਜੀ ਹਾਂਜੀ ਪਟਿਆਲੇ ਜ਼ਿਲ੍ਹੇ ਦੇ ਬਹੁਤ ਜ਼ਿਆਦਾ ਸ਼ ਜ਼ਿਲ੍ਹੇ ਦੁਕਾਨਾਂ ਮਸ਼ਹੂਰ ਨੇ ਜਿੱਥੇ ਤੁਹਾਨੂੰ ਬਹੁਤ ਵਧੀਆ ਰੇਂਜ 'ਤੇ ਅਤੇ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੀਆਂ ਜੁੱਤੀਆਂ ਮਿਲ ਸਕਦੀਆਂ ਹਨ ਜਿਵੇਂ ਕਿ ਕਢਾਈ ਵਾਲੀਆਂ ਹੋ ਗਈਆਂ ਚਮੜੇ ਦੀਆਂ ਜੁੱਤੀਆਂ ਹੋ ਗਈਆਂ ਇੱਦਾਂ ਹੀ ਤੁਸੀਂ ਲੁਧਿਆਣੇ ਸ਼ਹਿਰ ਜਾ ਕੇ ਉੱਥੋਂ ਵੀ ਤੁਸੀਂ ਬਹੁਤ ਵਧੀਆ ਤਰ੍ਹਾਂ ਦੀਆਂ ਜੁੱਤੀਆਂ ਅਤੇ ਫੁਲਕਾਰੀਆਂ ਵੀ ਲੈ ਸਕਦੇ ਹੋ ਹੋਰ ਹਾਂਜੀ ਅੰਮ੍ਰਿਤਸਰ ਹੋ ਗਿਆ ਉੱਥੇ ਵੀ ਬਹੁਤ ਜ਼ਿਆਦਾ ਵਧੀਆ ਤਰ੍ਹਾਂ ਦੀਆਂ ਜੁੱਤੀਆਂ ਫੁਲਕਾਰੀਆਂ ਜਿੱਦਾਂ ਦੀਆਂ ਵੀ ਤੁਸੀਂ ਚਾਹੁੰਦੇ ਹੋ ਪਾਰਟੀ ਵੇਅਰ ਹੋ ਗਈਆਂ ਘਰ ਪਾਉਣ ਵਾਲੀਆਂ ਹੋ ਗਈਆਂ ਅਗਰ ਸਟੋਰ ਕਰਨੀਆਂ ਹੋਣ ਤੁਸੀਂ ਸੇਲ ਕਰਨੀਆਂ ਹੋਣ ਅੱਗੇ ਉਹ ਵੀ ਤੁਹਾਨੂੰ ਵਧੀਆ ਰੇਂਜ 'ਤੇ ਮਿਲ ਸਕਦੀਆਂ ਨੇ ਹੋਲਸੇਲ ਰੇਟਾਂ 'ਤੇ ਪਟਿਆਲਾ ਜ਼ਿਲ੍ਹਾ ਹਾਂਜੀ ਬਹੁਤ ਵਧੀਆ ਉੱਥੇ ਵੀ ਤੁਹਾਨੂੰ ਮਿਲ ਸਕਦੀਆਂ ਨੇ ਹਾਂਜੀ ਹਾਂਜੀ ਲੁਧਿਆਣੇ ਵੀ ਮਾਲ ਬਹੁਤ ਸਸਤਾ ਹੈ ਅਤੇ ਜਿਵੇਂ ਪਟਿਆਲੇ ਵੀ ਹੋ ਗਿਆ ਜਿੱਥੋਂ ਮਰਜ਼ੀ ਤੁਸੀਂ ਆਪਣਾ ਮਾਲ ਲੈ ਕੇ ਅੱਗੇ ਵੇਚ ਸਕਦੇ ਹੋ ਜੁੱਤੀਆਂ ਬਹੁਤ ਹਾਂਜੀ ਫੁ ਫੁਲਕਾਰੀਆਂ 'ਤੇ ਤਾਂ ਬਹੁਤ ਵਧੀਆ ਵਰਕ ਕੀਤਾ ਜਾਂਦਾ ਹੈ ਜਿਵੇਂ ਪਟਿਆਲੇ ਵੀ ਮਸ਼ਹੂਰ ਹੈ ਲੁਧਿਆਣੇ ਵੀ ਇਹਨਾਂ ਦੀ ਕਢਾਈ ਬਹੁਤ ਵਧੀਆ ਕੀਤੀ ਜਾਂਦੀ ਹੈ ਇਹਨਾਂ ਨੂੰ ਤੁਸੀਂ ਕਿਸੇ ਵੀ ਢੰਗ ਨਾਲ਼ ਜਿੱਥੋਂ ਮਰਜ਼ੀ ਲੈ ਸਕਦੇ ਹੋ ਉੱਥੋਂ ਵੀ ਤੁਹਾਨੂੰ ਵਧੀਆ ਮਿਲ ਜਾਣਗੀਆਂ ਠੀਕ ਹੈ ਜੀ ਓਕੇ ਜੀ